ਹੈਲੋ ਹਾਂਜੀ ਮੈਂ ਨਾ ਤੁਹਾਡੇ ਕੋਲੋਂ ਮੰਗਵਾਇਆ ਸੀ ਸਕਾਈਬੈਗ ਦਾ ਟਰੋਲੀ ਬੈਗ ਅਤੇ ਸਭ ਤੋਂ ਪਹਿਲਾਂ ਚਲੋ ਧੰਨਵਾਦ ਜੀ ਕਾਫ਼ੀ ਵਧੀਆ ਪ੍ਰੋਡਕਟ ਨਿਕਲਿਆ ਅਤੇ ਟਾਈਮ ਸਿਰ ਮੈਨੂੰ ਮਿਲ ਗਿਆ ਬਹੁਤ ਵੱਡੀ ਗੱਲ ਇਹ ਸੀ ਮੈਂ ਪਹਿਲੀ ਵਾਰੀ ਔਨਲਾਈਨ ਕੋਈ ਪ੍ਰੋਡਕਟ ਮੰਗਵਾਇਆ ਸੀ ਮੈਨੂੰ ਜ਼ਿਆਦਾ ਮੈਂ ਫੇਥ ਨਹੀਂ ਕਰਦੀ ਪਰ ਕਾਫ਼ੀ ਵਧੀਆ ਨਿਕਲਿਆ ਉਹਦਾ ਮਟੀਰੀਅਲ ਆ ਜਿਹੜਾ ਜਿੱਦਾਂ ਦਾ ਮੈਂ ਚਾਹੁੰਦੀ ਸੀ ਉੱਦਾਂ ਦਾ ਹੈ ਅਤੇ ਬਾਕੀ ਗੱਲ ਇਹ ਆ ਕਿ ਉਹਦਾ ਜਿਹੜਾ ਵਾਟਰ ਪਰੂਫ ਹੈ ਮਨ ਲਉ ਜੇ ਗੰਦਾ ਹੁੰਦਾ ਕੱਪੜਾ ਮਾਰੋ ਤਾਂ ਸਾਫ ਫੋਰ ਵੀਲਰ ਆ ਉਹਨੂੰ ਕੋਈ ਚੁੱਕਣ ਦੇ ਵਿੱਚ ਇੱਧਰ ਉੱਧਰ ਰੇੜਨ ਦੇ ਵਿੱਚ ਕੋਈ ਸਮੱਸਿਆ ਨਹੀਂ ਆ ਅਤੇ ਕਾਫ਼ੀ ਵਧੀਆ ਪ੍ਰੋਡਕਟ ਆ ਜੀ ਬਾਕੀ ਉਹਦੀ ਜਿਹੜੀ ਕਪੈਸਿਟੀ ਹੈਗੀ ਉਹ ਵੀ ਗੁੱਡ ਹੈ ਉਹਦੇ ਵਿੱਚ ਇਹ ਕਿ ਵੱਖਰੇ ਵੱਖਰੇ ਤੁਸੀਂ ਉਹਦੇ ਵਿੱਚ ਖਾਨੇ ਦਿੱਤੇ ਆ ਜਿੱਦਾਂ ਛੋਟੇ ਆ ਛੋਟਾ ਸਮਾਨ ਆ ਸੋਕਸ ਨੇ ਮੇਕਅਪ ਦਾ ਸਮਾਨ ਆਂ ਅਤੇ ਆਪਣੀਆਂ ਜੈਕਟ ਵਗੈਰਾ ਨੇ ਉਹ ਵੱਖਰੀਆਂ ਰੱਖ ਸਕਦੇ ਹਾਂ ਛੋਟੇ ਬੱਚੇ ਲਈ ਵੀ ਇੱਕ ਵੱਖਰਾ ਦਿੱਤਾ ਹੈ ਕਾਫ਼ੀ ਵਧੀਆ ਲੱਗਿਆ ਜੀ ਮੈਨੂੰ ਕਾਫ਼ੀ ਵਧੀਆ ਮਟੀਰੀਅਲ ਆ ਅਤੇ ਕਲਰ ਵੀ ਜੋ ਮੈਂ ਵਿੱਚ ਦਿੱਤਾ ਸੀ ਮੈਂ ਮੈਨਸ਼ਨ ਕੀਤਾ ਸੀ ਕਿ ਮੈਨੂੰ ਬਲੂ ਕਲਰ ਦਾ ਹੀ ਚਾਹੀਦਾ ਉਹ ਹੀ ਮਿਲਿਆ ਕਾਫ਼ੀ ਵਧੀਆ ਪ੍ਰੋਡਕਟ ਆ ਧੰਨਵਾਦ ਕਿਉਂਕਿ ਇਹ ਆ ਕਿ ਚਲੋ ਅੱਗੇ ਵਾਸਤੇ ਵੀ ਤਾਂ ਫੇਥ ਆ ਕਿ ਮੈਂ ਅੱਗੋਂ ਜੋ ਤੁਹਾਡੇ ਤੋਂ ਕੋਈ ਇਸ ਤਰ੍ਹਾਂ ਦਾ ਪ੍ਰੋਡਕਟ ਮੰਗਾਉਂਦੀ ਆ ਤਾਂ ਤੁਸੀਂ ਉਹ ਮੈਨੂੰ ਵਧੀਆ ਹੀ ਭੇਜੋਗੇ ਇਹ ਉਮੀਦ ਕਰਦੀ